ਟਕਨੋਲਜੀ ਅਤੇ ਇੰਟਰਨੈਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਬਦਲ ਗਈ ਹੈ ਟਕਨੋਲਜੀ ਵਧਣ ਨਾਲ ਪੰਜਾਬੀ ਭਾਸ਼ਾ ਵਿੱਚ ਸ਼ਬਦ ਜੋੜਾ ਦਾ ਬਹੁਤ ਮਸਲਾ ਆ ਰਿਹਾ ਇਸ ਵਿੱਚ ਸਿਹਾਰੀ ਬਿਹਾਰੀ ਸਹੀ ਨਹੀਂ ਲਗਾਈ ਜਾਂਦੀ ਸ਼ਬਦ ਕਈ ਗਲਤ ਲਿਖੇ ਜਾਂਦੇ ਹਨ ਕਿਉਂਕਿ ਅੱਜ ਕੱਲ ਬੱਚਾ ਉਸੇ ਤਰ੍ਹਾਂ ਹੀ ਬੁੱਕਸ ਪੁਸਤਕ ਪੜਦਾ ਹੈ ਜਿਸ ਤਰ੍ਹਾਂ ਪੁਸਤਕ ਲਿਖੀ ਜਾਂਦੀ ਹੈ ਸਿਹਾਰੀ ਬਿਹਾਰੀ ਉਸ ਵਿੱਚ ਗਲਤ ਹੁੰਦੀ ਹੈ ਸਕੂਲਾਂ ਵਿੱਚ ਵੀ ਇੰਟਰਨੈਟ ਰਾਹੀਂ ਪੜਾਇਆ ਜਾਂਦਾ ਹੈ ਜਿਸ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਪੰਜਾਬੀ ਨੂੰ ਵੀ ਅੰਗਰੇਜ਼ੀ ਅੰਗਰੇਜ਼ੀ ਰਾਹੀਂ ਲਿਖਿਆ ਜਾਂਦਾ ਹੈ ਟਕਨੋਲਜੀ ਨਾਲ ਜਿਵੇਂ ਯੂਟੀਊਬ ਵਿੱਚ ਕਾਰਟੂਨ ਬੱਚਿਆਂ ਵੱਲੋਂ ਕਾਰਟੂਨ ਵੇਖੇ ਜਾਂਦੇ ਹਨ ਉਸ ਵਿੱਚ ਵੀ ਅੰਗਰੇਜ਼ੀ ਅਤੇ ਹਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਬੱਚੇ ਕਾਟੂਨ ਰਾਹੀਂ ਅੰਗਰੇਜ਼ੀ ਬੋਲਦੇ ਹਨ ਹਿੰਦੀ ਬੋਲਦੇ ਹਨ ਅਤੇ ਪੰਜਾਬੀ ਨੂੰ ਤਾਂ ਭੁੱਲਦੇ ਹੀ ਜਾ ਰਹੇ ਹਨ ਸੋਸ਼ਲ ਮੀਡੀਆ ਵਿੱਚ ਵੀ ਪੰਜਾਬੀ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਐ ਸੋਸ਼ਲ ਮੀਡੀਆ ਵਿੱਚ ਜਿਵੇਂ ਵਟਸਐਪ ਹੋ ਗਿਆ ਸਨੈਪਚੈਟ ਆਦ ਮੈਸੇਜ ਕਰਨ ਲਈ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾਂਦੀ ਉਸ ਵਿੱਚ ਵੀ ਪੰਜਾਬੀ ਨੂੰ ਲਿਖਣ ਲਈ ਰੋਮਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਬਹੁਤ ਦੀ ਵਰਤੋਂ ਬਹੁਤ ਬਦਲ ਚੁੱਕੀ ਐ ਇਸ ਲਈ ਪੰਜਾਬੀ ਭਾਸ਼ਾ ਨੂੰ ਵੀ ਇੰਟਰਨੈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ